ਹਾਂਜੀ ਮਿਸ਼ੋ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਤੁਹਾਡੇ ਕੋਲੋਂ ਇੱਕ ਪਰਸ ਅੋਰਡਰ ਕੀਤਾ ਸੀ ਜੋ ਕਿ ਮੈਨੂੰ ਬਹੁਤ ਪਸੰਦ ਆਇਆ ਕੁਛ ਬਲੂ ਕਲਰ ਦਾ ਮੈਂ ਤੁਹਾਡੇ ਕੋਲੋਂ ਮੰਗਵਾਇਆ ਸੀ ਉਸਦੀ ਕੁਆਲਿਟੀ ਮੈਨੂੰ ਬਹੁਤ ਚੰਗੀ ਲੱਗੀ ਮੇਰੇ ਫਰੈਂਡਸ ਨੂੰ ਮੇਰੇ ਫੈਮਲੀਜ਼ ਨੂੰ ਵੀ ਬਹੁਤ ਚੰਗੀ ਲੱਗੀ ਉਹ ਵੀ ਕਹਿ ਰਹੇ ਸੀ ਕਿ ਅਸੀਂ ਇਹਨਾਂ ਕੋਲੋਂ ਹੀ ਅੋਰਡਰ ਕਰਨਾ ਹੈ ਇਸ ਕਰਕੇ ਤੁਹਾਡੇ ਜਿਹੜੇ ਵੀ ਪ੍ਰੋਡਕਟ ਮੈਂ ਅੱਜ ਤੱਕ ਮੰਗਵਾ ਰਹੀ ਹਾਂ ਮੈਨੂੰ ਉਹਨਾਂ ਦੀ ਬਹੁਤ ਚੰਗੀ ਲੱਗੀ ਵਰਾਇਟੀ ਬਹੁਤ ਚੰਗੀ ਲੱਗ ਰਹੀ ਹੈ ਮੈਂ ਤੁਹਾਨੂੰ ਫੀਡਬੈਕ ਬਹੁਤ ਜਲਦੀ ਦੇਵਾਂਗੀ ਉਹ ਤੁਹਾਡੇ ਹਰ ਪ੍ਰੋਡਕਟ ਵਿੱਚ ਇੱਕ ਵੱਖਰੀ ਹੀ ਮਤਲਬ ਕਿ ਖਾਸੀਅਤ ਹੁੰਦੀ ਹੈ ਜੋ ਕਿ ਸਾਨੂੰ ਬਹੁਤ ਪਸੰਦ ਆਉਂਦੀ ਹੈ ਪਿਛਲੀ ਵਾਰ ਵੀ ਮੈਂ ਇੱਕ ਦੋ ਚੀਜ਼ਾਂ ਮੰਗਵਾਈਆਂ ਸੀ ਜੋ ਕਿ ਬਹੁਤ ਚੰਗੀਆਂ ਲੱਗੀਆਂ ਥੋੜ੍ਹੀ ਜਿਹੀ ਘਰ ਘਰ ਦੀਆਂ ਚੀਜ਼ਾਂ ਮੰਗਵਾਈਆਂ ਬੱਚੇ ਦੇ ਵਾਸਤੇ ਮੰਗਵਾਈਆਂ ਜੋ ਕਿ ਉਹਨਾਂ ਦਾ ਮੈਨੂੰ ਰਿਜ਼ਲਟ ਬਹੁਤ ਚੰਗਾ ਲੱਗਾ ਇਸ ਕਰਕੇ ਮੈਂ ਇਸ ਵਾਰ ਫਿਰ ਇੱਕ ਪਰਸ ਅੋਰਡਰ ਕੀਤਾ ਸੀ ਜਿਸ ਦੀ ਕੁਆਂਟਿਟੀ ਵੀ ਬਹੁਤ ਚੰਗੀ ਹੈ ਅਤੇ ਉਸਦਾ ਉਸਦਾ ਮਤਲਬ ਕਿ ਕੱਪੜਾ ਵੀ ਬਹੁਤ ਚੰਗਾ ਲੱਗਾ ਹੋਇਆ ਹੈ ਇਸ ਕਰਕੇ ਮੇਰੇ ਫਰੈਂਡਸ ਨੇ ਵੀ ਉਹੀ ਚੀਜ਼ ਅੋਰਡਰ ਕੀਤੀ ਹੈ ਮੇਰੇ ਤੋਂ ਦੇਖ ਕੇ ਕਿ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਾ ਇਹ ਪਰਸ ਇੱਦਾਂ ਹੀ ਮੈਂ ਤੁਹਾਡੇ ਕੋਲੋਂ ਚੀਜ਼ਾਂ ਮੰਗਵਾਉਂਦੀ ਰਹਿੰਦੀ ਹਾਂ ਅਤੇ ਮੈਨੂੰ ਬਹੁਤ ਅੱਛੀ ਫੀਡਬੈਕ ਮਿਲਦੀ ਹੈ ਅਤੇ ਇੱਦਾਂ ਹੀ ਮੈਂ ਤੁਹਾਨੂੰ ਫੀਡਬੈਕ ਚੰਗੀ ਆਪਣੇ ਵੱਲੋਂ ਤੁਹਾਨੂੰ ਵਾਪਿਸ ਕਰ ਰਹੀ ਹਾਂ ਇਸ ਕਰਕੇ ਜੋ ਵੀ ਹੁਣ ਮੈਂ ਤੁਹਾਡੇ ਕੋਲੋਂ ਮੰਗਵਾ ਰਹੀ ਹਾਂ ਮੈਨੂੰ ਬਹੁਤ ਚੰਗਾ ਲੱਗ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਕੰਪਨੀ ਦਾ ਜੋ ਕਿ ਤੁਸੀਂ ਐਡੇ ਵਧੀਆ ਪ੍ਰੋਡਕਟ ਲੋਂਚ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ